ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕੀ ਕਰ ਰਹੇ ਹੋ ਫਰੀ ਹੋ ਤੁਸੀਂ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਇੱਧਰ ਚਿੰਤਪੁਰਨੀ ਵਾਲੀ ਸਾਈਡ ਘੁੰਮਣ ਆਈ ਸੀ ਹਾਂਜੀ ਅਤੇ ਮੇਰੇ ਬੱਚੇ ਵੀ ਨਾਲ ਆਏ ਹੋਏ ਆ ਹਾਂਜੀ ਮੈਂ ਤਹਾਨੂੰ ਪੁੱਛਣਾ ਸੀ ਕਿ ਇੱਧਰ ਕਿਹੜਾ ਰੈਸਟੋਰੈਂਟ ਵਧੀਆ ਆ ਕਿੱਥੇ ਅਸੀਂ ਖਾ ਪੀ ਸਕੀਏ ਬੈਸਟ ਮਿਲ ਜਾਵੇ ਅੱਛਾ ਜੀ ਅੱਛਾ ਜੀ ਅੱਛਾ ਜੀ ਮੈਂ ਪਹਿਲਾਂ ਵੀ ਉੱਥੇ ਗਈ ਹੋਈ ਹਾਂ ਵੈਸੇ ਤਾਂ ਅਤੇ ਪਰ ਇਸ ਤੋਂ ਇਲਾਵਾ ਵੀ ਕੋਈ ਹੈ ਉਸ ਸਾਈਡ 'ਤੇ ਕੁੱਛ ਪਿਓਰ ਵੈਜੀਟੇਰੀਆਨ ਹਾਂ ਅਸੀਂ ਬਿਲਕੁਲ ਵੀ ਅਸੀਂ ਚਿਕਨ ਤਾਂ ਬਿਲਕੁਲ ਨਹੀਂ ਉੱਥੇ ਤਾਂ ਨਹੀਂ ਆ ਅੱਛਾ ਜੀ ਕਿੱਥੇ ਬੰਬੇ ਪਿਕਨਿਕ ਸਪੋਟ ਕਿ ਅੰਬਰ ਵਿੱਚ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਗਏ ਹੋਏ ਹੋ ਮਤਲਬ ਪਹਿਲਾਂ ਉੱਥੇ ਅੱਛਾ ਜੀ ਫਿਰ ਆ ਜਾਓ ਹੁਣ ਵੀ ਆ ਜਾਓ ਇੱਧਰ ਨੂੰ ਤੁਸੀਂ ਕੀ ਫੂਡ ਕਿਹੜਾ ਫੇਮਸ ਆ ਉੱਥੇ ਕਿਹੜਾ ਫੂਡ ਫੇਮਸ ਲੱਗਾ ਤੁਹਾਨੂੰ ਉੱਥੇ ਕੀ ਬੈਸਟ ਸੀਗਾ ਉੱਥੇ ਤੁਹਾਨੂੰ ਜ਼ਿਆਦਾ ਹੀ ਪਸੰਦ ਆ ਗਿਆ ਲੱਗਦਾ ਠੀਕ ਜੀ ਜੀ ਠੀਕ ਹੈ ਸਰ ਠੀਕ ਹੈ ਹਾਂਜੀ ਹਾਂ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਓਕੇ